ਛੇ ਜੂਨ ਉੱਨੀ ਸੌ ਚੁਰਾਸੀ ਨੌਂ ਨਵੰਬਰ ਉੱਨੀ ਸੌ ਚਾਲੀ ਦਸ ਮਾਰਚ ਦੋ ਹਜ਼ਾਰ ਚਾਰ ਤੇਈ ਮਾਰਚ ਉੱਨੀ ਸੌ ਇਕੱਤੀ ਇੱਕ ਜਨਵਰੀ ਦੋ ਹਜ਼ਾਰ ਦਸ